ਹੈਲੋ ਹਾਂਜੀ ਹਾਂਜੀ ਮੈਮ ਹਾਂਜੀ ਮੈਂ ਕਦੋਂ ਕ ਕਦੋਂ ਆ ਜੀ ਤੁਹਾਡੇ ਵਿਆਹ ਠੀਕ ਹੈ ਜੀ ਠੀਕ ਹੈ ਮਾਤਾ ਅਤੇ ਮਿਲ ਜਾਣਗੇ ਅਤੇ ਤੁਸੀਂ ਪਹਿਲਾਂ ਵੀ ਸਾਨੂੰ ਪਹਿਲਾਂ ਦੇ ਜਿਓ ਕਿਉਂਕਿ ਫੇਰ ਹੋਰ ਵੀ ਅੱਗੇ ਜ਼ਿਆਦਾ ਕੰਮ ਹੈ ਨਾ ਜੀ ਹਾਂ ਅਤੇ ਇਸ ਕਰਕੇ ਸਾਨੂੰ ਜਲਦੀ ਦੇ ਦਿਓ ਅਤੇ ਤੁਹਾਡਾ ਹਾਂਜੀ ਹਾਂਜੀ ਹਾਂ ਕਰਦੇ ਆਪਾਂ ਸਭ ਕੰਮ ਕਰ ਦਵਾਂਗੇ ਜੀ ਲੇਡੀਜ ਵੀ ਕਰ ਦਵਾਂਗੇ ਬੱਚਿਆਂ ਦਾ ਵੀ ਕਰ ਦਵਾਂਗੇ ਹਾਂਜੀ ਹਾਂ ਹਾਂ ਸਭ ਸ ਹਾਂਜੀ ਬਣਾ ਦਵਾਂਗੇ ਵੀ ਬਣਾਵਾਂਗੇ ਹਾਂਜੀ ਹਾਂਜੀ ਹਾਂਜੀ ਹਾਂ ਹਾਂ ਹਾਂਜੀ ਹਾਂ ਹਾਂਜੀ ਹਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਦੁਕਾਨ 'ਤੇ ਆ ਜਾਇਓ ਆਪਣੇ 'ਤੇ ਆਪਾਂ ਦੁਕਾਨ 'ਤੇ ਕੋਈ ਨਾ ਕਰ ਲਵਾਂਗੇ ਜੀ ਬਹਿ ਕੇ ਗੱਲ ਕਰ ਲਵਾਂਗੇ ਹਾਂਜੀ ਹਾਂ ਹਾਂਜੀ ਹਾਂ ਤੁਸੀਂ ਬਸ ਮੈਨੂੰ ਪਹਿਲਾਂ ਦੇ ਜਿਓ ਵੀ ਪੰਜ ਸੱਤ ਦਿਨ ਪਹਿਲਾਂ ਦੇ ਜਿਓ ਮੈਂ ਤੁਹਾਨੂੰ ਪੰਜ ਸੱਤ ਦਿਨਾਂ ਦੇ ਵਿੱਚ ਤਿਆਰ ਕਰਕੇ ਦੇ ਦੂੰਗਾ ਤੁਹਾਡੇ ਜਿੰਨੇ ਵੀ ਕੱਪੜੇ ਹੋਣਗੇ ਹਾਂ ਹਾਂਜੀ ਹਾਂ ਮਾਤਾ ਕਰ ਦਵਾਂਗੇ ਉਹ ਬਸ ਥੋੜ੍ਹਾ ਜਿਹਾ ਐਕਸਟਰਾ ਚਾਰਜ ਲੱਗਦਾ ਜੀ ਉਹਨਾਂ 'ਤੇ

ਹਾਂ ਮਾਤਾ ਦੇ ਦਿਓ ਦੇ ਦਿਓ ਕੋਈ ਗੱਲ ਨਹੀਂ ਤੁਸੀਂ ਆ ਜਿਓ ਆਪਣੀ ਸ਼ੌਪ 'ਤੇ ਸ਼ੌਪ ਦਾ ਤਾਂ ਪਤਾ ਤੁਹਾਨੂੰ ਮਾਤਾ ਕਿੱਥੇ ਆ ਸ਼ੌਪ ਦਾ ਤਾਂ ਪਤਾ ਤੁਹਾਨੂੰ ਕਿੱਥੇ ਆ ਬਸ ਹਾਂਜੀ ਹਾਂ ਮਾਤਾ ਹਾਂਜੀ ਹਾਂਜੀ ਜਲਦੀ ਤੋਂ ਜਲਦੀ ਫਿਰ ਦੇ ਜਿਓ ਫੇਰ ਕਿਉਂਕਿ ਅੱਗੇ ਕੰਮ ਆ ਨਾ ਜੀ ਫੇਰ ਤੁਹਾਡਾ ਕੰਮ ਲੇਟ ਨਾ ਹੋਜੇ ਨਹੀਂ ਨਹੀਂ ਜੀ ਪੂਰਾ ਤਸੱਲੀ ਵਾਲਾ ਕੰਮ ਕਰਕੇ ਦਵਾਂਗੇ ਜੀ ਪੂਰਾ ਵਧੀਆ ਜੀ ਤੁਸੀਂ ਇੱਕ ਵਾਰੀ ਤਾਂ ਕੰਮ ਕਰਵਾ ਕੇ ਵੇਖਿਉ ਜੀ ਹਾਂਜੀ